ਵੈਸੇ ਤਾਂ ਸਾਰੀਆਂ ਹੀ ਕਲਾਵਾਂ ਸ਼ਿਲਪਕਾਰੀ ਕੱਪੜੇ ਦੀਆਂ ਸਮੱਗਰੀਆਂ ਖ਼ਾਸ ਹੀ ਹਨ ਇਹਨਾਂ ਸਭਨਾਂ ਦਾ ਆਪੋ ਆਪਣੀ ਜਗ੍ਹਾ 'ਤੇ ਇੱਕ ਅਲੱਗ ਹੀ ਮਹੱਤਵ ਹੈ ਲੋਕ ਕਲਾਵਾਂ ਮਨੁੱਖ ਦੀਆਂ ਸੁਹਜਾਤਮਕ ਲੋੜਾਂ ਦੀ ਤ੍ਰਿਪਤੀ ਦਾ ਸਾਧਨ ਹਨ ਪਰ ਇਸ ਦੇ ਨਾਲ ਹੀ ਇੱਕ ਗੱਲ ਵਿਸ਼ੇਸ਼ ਧਿਆਨ ਦੇਣ ਯੋਗ ਹੈ ਕਿ ਲੋਕ ਕਲਾ ਦੀਆਂ ਕੁਝ ਵਣਗੀਆਂ ਸੁਹਜਾਤਮਕ ਤ੍ਰਿਪਤੀ ਤੋਂ ਪਹਿਲਾਂ ਮਨੁੱਖ ਦੀਆਂ ਪ੍ਰਯੋਗ ਆਤਮਕ ਲੋੜਾਂ ਦੀ ਪੂਰਤੀ ਕਰਦੀਆਂ ਹਨ ਅਤੇ ਇਸ ਦੇ ਨਾਲ ਹੀ ਸਮਾਜ ਦੇ ਵਿਭਿੰਨ ਪੱਖਾਂ ਦੀ ਨਿਸ਼ਾਨਦੇਹੀ ਕਰਨ ਦੇ ਸਮਰੱਥ ਹੁੰਦੀਆਂ ਹਨ ਸ਼ਿਲਪਕਾਰੀ ਬੁਣਨ ਕਲਾ ਅਜਿਹੀਆਂ ਵਣਗੀਆਂ ਵਿੱਚੋਂ ਇੱਕ ਹੈ ਕੱਪੜੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਾਈਆਂ ਜਾਂਦੀਆਂ ਹਨ ਕੱਪੜਿਆਂ ਦੇ ਉੱਤੇ ਵੀ ਸਮੱਗਰੀਆਂ ਲੱਗਦੀਆਂ ਹਨ ਜਿਵੇਂ ਕਿ ਹੋ ਗਏ ਆਪਣੇ ਗੋਟੇ ਪੱਤੀ ਪਤਾਸੇ ਜਿਹੜੇ ਕਿ ਕੱਪੜਿਆਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਸੁੰਦਰਤਾ ਨਾਲ ਪੇਸ਼ ਕਰਦੇ ਹਨ ਹੋਰ ਵੀ ਕਈ ਤਰ੍ਹਾਂ ਦੀਆਂ ਸ਼ਿਲਪਕਾਰੀਆਂ ਜਿਵੇਂ ਕਿ ਨਾਲਾ ਬੁਣਨਾ ਮੰਜਾ ਉਣਨਾ ਡੋਰੀਆਂ ਬਣਾਉਣੀਆਂ ਖੇਸਾਂ ਦੇ ਡੋਰੇ ਵੱਟਣੇ ਅਤੇ ਆਪਣੇ ਪੱਖੀਆਂ ਬਣਉਣੀਆਂ ਪੀੜੀਆਂ ਬੁਣਨੀਆਂ ਨਾਲੇ ਬਣਾਉਣੇ ਪਰਾਂਦੇ ਗੁੰਦਣੇ ਫੁਲਕਾਰੀਆਂ ਕੱਢਣੀਆਂ ਸੂਟ ਕੱਢਣੇ ਵੱਖ ਵੱਖ ਤਰ੍ਹਾਂ ਦੇ ਹੱਥੀਂ ਵਰਕ ਕਰਨੇ ਸੂਟਾਂ ਦੇ ਉੱਤੇ ਚੁੰਨੀਆਂ ਦੇ ਉੱਤੇ ਗੋਟੇ ਲਾਉਣੇ ਕਈ ਤਰ੍ਹਾਂ ਦੀਆਂ ਕਲਾਵਾਂ ਹਨ ਜੋ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਖ਼ਾਸ ਹਨ ਹਰੇਕ ਦਾ ਆਪਣਾ ਆਪਣਾ ਮਹੱਤਵ ਹੈ ਕੋਈ ਵੀ ਘੱਟ ਨਹੀਂ ਹੈ ਕਿਸੇ ਨਾਲੋਂ ਸਭਨਾਂ ਦਾ ਅਣਮੁੱਲਾ ਹੀ ਇੱਕ ਗਹਿਣਾ ਹਨ ਇਹ ਸੱਭਿਆਚਾਰ ਦਾ